ਹਾਂ ਮੈਨੂੰ ਦੂਜਿਆਂ ਨੂੰ ਦਾਂ ਡਾਂਸ ਸਿਖਾਉਣ ਦਾ ਮੌਕਾ ਮਿਲਿਆ ਹੈ ਜਦੋਂ ਕਿ ਜਦੋਂ ਮੈਂ ਭੰਗੜੇ ਦੀ ਪ੍ਰੈਕਟਿਸ ਕਰਦੀ ਹੁੰਦੀ ਸੀ ਤਾਂ ਸਾਡੇ ਇੱਕ ਟੀਚਰ ਹੁੰਦੇ ਸੀ ਜਿਹੜੇ ਕਿ ਸਾਨੂੰ ਭੰਗੜਾ ਸਿਖਾਉਂਦੇ ਹੁੰਦੇ ਸੀ ਪਰ ਉਸ ਟਾਈਮ ਜਦੋਂ ਅਸੀਂ ਸਾਨੂੰ ਸਰ ਨੇ ਭੰਗੜਾ ਸਿਖਾ ਦਿੱਤਾ ਸੀਗਾ ਤਾਂ ਜਦੋਂ ਨਵੇਂ ਬੱਚੇ ਆਉਂਦੇ ਸੀ ਤਾਂ ਉਹ ਸਾਨੂੰ ਜਿਹੜੇ ਸਿਖਾਏ ਗਏ ਸਟੈਪ ਸੀਗੇ ਉਹ ਉਨ੍ਹਾਂ ਬੱਚਿਆਂ ਨੂੰ ਸਿਖਾਉਣ ਨੂੰ ਕਹਿੰਦੇ ਸੀ ਉਸ ਟਾਈਮ ਮੈਂ ਉਹ ਸਟੈਪ ਆਪਣੇ ਤੋਂ ਜਿਹੜੇ ਨਵੇਂ ਆਏ ਬੱਚਿਆਂ ਨੂੰ ਸਿਖਾਉਂਦੀ ਸੀ ਤਾਂ ਉਹ ਅਨੁਭਵ ਮੈਨੂੰ ਬਹੁਤ ਵਧੀਆ ਲੱਗਦਾ ਸੀ ਜਦੋਂ ਆਪਾਂ ਕਿਸੇ ਚੀਜ਼ ਨੂੰ ਆਪ ਸਿੱਖ ਕੇ ਕਿਸੇ ਨੂੰ ਸਿਖਾਉਂਦੇ ਹਾਂ ਤਾਂ ਉਹ ਅਨੁਭਵ ਬਹੁਤ ਹੀ ਵਧੀਆ ਹੁੰਦਾ ਹੈ ਜਿਵੇਂ ਕਿ ਜਿਹੜੇ ਜਿਹੜੇ ਸਟੈਪ ਮੈ ਨੂੰ ਆਉਂਦੇ ਸੀ ਮੈਂ ਉਨ੍ਹਾਂ ਨੂੰ ਸਿਖਾਏ ਅਤੇ ਇਸ ਨਾਲ ਮੇਰੇ ਜਿਹੜੇ ਸਟੈਪ ਕਲੀਅਰ ਪਹਿਲਾਂ ਨਹੀਂ ਸੀ ਐਨੇ ਉਹ ਉਹ ਤੋਂ ਬਾਅਦ ਬਹੁਤ ਹੀ ਜ਼ਿਆਦਾ ਵਧੀਆ ਹੋ ਗਏ ਸੀ ਇਸ ਲਈ ਜਦੋਂ ਆਪਾਂ ਕਿਸੇ ਨੂੰ ਵੀ ਕੋਈ ਸਿੱਖੀ ਹੋਈ ਚੀਜ਼ ਸਿਖਾਉਂਦੇ ਹਾਂ ਤਾਂ ਦੂਜਿਆਂ ਦੇ ਗਿਆਨ ਤਾਂ ਵਿੱਚ ਤਾਂ ਵਾਧਾ ਹੁੰਦਾ ਹੀ ਹੁੰਦਾ ਹੈ ਪਰ ਉਸ ਨਾਲ ਆਪਣੇ ਹੀ ਵੀ ਗਿਆਨ 'ਚ ਬਹੁਤ ਜ਼ਿਆਦਾ ਸੁਧਾਰ ਆਉਂਦਾ ਹੈ ਇਸ ਲਈ ਕਦੇ ਵੀ ਕਿਸੇ ਨੂੰ ਵੀ ਆਪਣੀ ਚੀਜ਼ ਸਿਖਾਉਣ ਲਈ ਆਪਣਾ ਗਿਆਨ ਦੇਣ ਤੋਂ ਪਹਿਲਾਂ ਇਹ ਨਹੀਂ ਸੋਚਣਾ ਚਾਹੀਦਾ ਕਿ ਮੈਂ ਆਪਣਾ ਗਿਆਨ ਕਿਉਂ ਕਿਸੇ ਨੂੰ ਦਵਾਂ ਇਹ ਸੋਚ ਕੇ ਆਪਣਾ ਗਿਆਨ ਦੇਣਾ ਚਾਹੀਦਾ ਹੈ ਕਿ ਗਿਆਨ ਜਿੰਨਾ ਵੰਡਿਆ ਜਾਂਦਾ ਹੈ ਓਨਾ ਹੀ ਵੱਧਦਾ ਹੈ